ਸਤਿ ਸ਼੍ਰੀ ਅਕਾਲ ਮੇਰਾ ਨਾਮ ਅੰਸ਼ ਮਹਾਜਨ ਹੈ ਮੈਂ ਪਠਾਨਕੋਟ ਸ਼ਹਿਰ ਦਾ ਰਹਿਣ ਵਾਲਾ ਹਾਂ ਅਤੇ ਅੱਜ ਮੈਂ ਤੁਹਾਨੂੰ ਕਲਾ ਅਤੇ ਸ਼ਿਲਪਕਾਰੀ ਦਾ ਮਹੱਤਵ ਆਪਣੀ ਸਭਿਅਤਾ ਵਿੱਚ ਦੱਸਣ ਜਾ ਰਿਹਾ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕਲਾ ਦਾ ਮਤਲਬ ਹੁੰਦਾ ਹੈ ਕਿਸੇ ਕੰਮ ਨੂੰ ਕਰਨ ਦਾ ਸਹੀ ਢੰਗ ਆਉਣਾ ਅਤੇ ਸ਼ਿਲਪਕਾਰੀ ਦਾ ਮਤਲਬ ਹੁੰਦਾ ਹੈ ਕਿਸੇ ਵੀ ਚੀਜ਼ 'ਤੇ ਚਿੱਤਰਕਾਰੀ ਕੱਢਣੀ ਸ਼ਿਲਪਕਾਰੀ ਦੋ ਪ੍ਰਕਾਰ ਦੀ ਹੁੰਦੀ ਹੈ ਪੱਥਰ ਸ਼ਿਲਪਕਾਰੀ ਅਤੇ ਲੋਹਾ ਸ਼ਿਲਪਕਾਰੀ ਜਿਹੜੀ ਪੱਥਰ ਸ਼ਿਲਪਕਾਰੀ ਹੁੰਦੀ ਹੈ ਉਹ ਸਿਰਫ਼ ਪੱਥਰ 'ਤੇ ਹੀ ਕੀਤੀ ਜਾਂਦੀ ਹੈ ਅਤੇ ਜਿਹੜੀ ਲੋਹਾ ਸ਼ਿਲਪਕਾਰੀ ਹੁੰਦੀ ਹੈ ਉਹ ਸਿਰਫ਼ ਲੋਹੇ ਵਰਗੀ ਚੀਜ਼ਾਂ 'ਤੇ ਹੀ ਕੀਤੀ ਜਾਂਦੀ ਹੈ ਕਲਾ ਅਤੇ ਸ਼ਿਲਪਕਾਰੀ ਨੂੰ ਅਸੀਂ ਆਪਣੇ ਭਾਵ ਪ੍ਰਗਟ ਕਰਨ ਵਾਸਤੇ ਵੀ ਇਸਤੇਮਾਲ ਕਰਦੇ ਹਾਂ ਤਾਂਕਿ ਬੰਦੇ ਨੂੰ ਪਤਾ ਚੱਲ ਸਕੇ ਕਿ ਦੂਜੇ ਦੇ ਮਨ 'ਚ ਕੀ ਚੱਲ ਰਿਹਾ ਜਾਂ ਕੀ ਬੰਦਾ ਕੀ ਸੋਚਦਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਪੂਰਵਜ ਜਦੋਂ ਪੁਰਾਣੇ ਜਮਾਨੇ ਵਿੱਚ ਰਹਿੰਦੇ ਸੀ ਤਾਂ ਉਹਨਾਂ ਨੇ ਵੀ ਆਪਣੇ ਸਾਰੇ ਭਾਵ ਦੀਵਾਰਾਂ 'ਤੇ ਚਿੱਤਰ ਬਣਾ ਬਣਾ ਕੇ ਪ੍ਰਗਟ ਕੀਤੇ ਦੇ ਸੀ ਅਤੇ ਉਹ ਬਿਲਕੁਲ ਸਹੀ ਤਰੀਕਾ ਸੀ ਤਦ ਹੀ ਸਾਨੂੰ ਲੱਗ ਪਾਇਆ ਕਿ ਉਹਨਾਂ ਦਾ ਟਾਈਮ ਕਿੱਦਾਂ ਦਾ ਹੁੰਦਾ ਸੀ ਅਤੇ ਪਰ ਸ਼ਿਲਪਕਾਰੀ ਅਤੇ ਸ਼ਿਲਪਕਾਰੀ ਅਤੇ ਕਲਾ ਨੂੰ ਅਸੀਂ ਇੱਕ ਭਾਸ਼ਾ ਦੀ ਤਰ੍ਹਾਂ ਵੀ ਇਸਤੇਮਾਲ ਕਰਦੇ ਹਾਂ ਕਿਉਂਕਿ ਇਹ ਇੱਕ ਦੂਜੇ ਦੇ ਭਾਵ ਪ੍ਰਗਟ ਕਰਦਾ ਹੈ ਤੁਹਾਨੂੰ ਪਤਾ ਹੀ ਹੈ ਕਿ ਕਲਾ ਅਤੇ ਸ਼ਿਲਪਕਾਰੀ ਦੀਆਂ ਗਹਿਰੀਆਂ ਜੜ੍ਹਾਵਾਂ ਸਾਡੇ ਇਤਿਹਾਸ ਨੂੰ ਦਰਸਾਉਂਦੀਆਂ ਹਨ ਅਤੇ ਸਾਡੀ ਸੱਭਿਅਤਾ ਨੂੰ ਵੀ ਦੱਸਦੀਆਂ ਹਨ ਕਲਾ ਅਤੇ ਸ਼ਿਲਪਕਾਰੀ ਬਹੁਤ ਹੀ ਮਹੱਤਵਪੂਰਨ ਹੈ ਸਾਡੀ ਸਭਿਅਤਾ ਵਾਸਤੇ ਮੈਂ ਇਸ 'ਤੇ ਬਸ ਇੰਨਾ ਹੀ ਬੋਲਣਾ ਚਾਹਾਂਗਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ